ਮੈਨੂੰ ਖੇਡਣ ਦਾ ਬਹੁਤ ਸ਼ੌਂਕ ਹੈ ਮੈਂ ਬਚਪਨ ਵਿੱਚ ਹੀ ਬਹੁਤ ਸਾਰੀਆਂ ਖੇਡਾਂ ਖੇਡਦੀ ਸਾਂ ਪਰ ਕ੍ਰਿਕਟ ਖੇਡ ਮੇਰੀ ਸਭ ਤੋਂ ਹਰਮਨ ਪਿਆਰੀ ਖੇਡ ਹੈ ਅਸੀਂ ਆਪਣੇ ਘਰ ਦੇ ਵਿਹੜੇ ਜਾਂ ਗਲੀ ਵਿੱਚ ਕ੍ਰਿਕਟ ਖੇਡਦੇ ਸੀ ਇਹ ਖੇਡ ਦੇ ਮੈਚ ਵੀ ਮੈਂ ਸਟੇਡੀਅਮ ਵਿੱਚ ਦੇਖਣ ਜਾਂਦੀ ਸੀ ਮੈਂ ਘਰ ਵਿੱਚ ਵੀ ਮੈਚ ਦੇਖਦੀ ਰਹਿੰਦੀ ਹਾਂ ਜਿਵੇਂ ਸਮਾਰਟਫੋ ਯੂਟੀਊਬ ਰਾਹੀਂ ਜਾਂ ਓ ਟੀ ਟੀ ਚੈਨਲ ਰਾਹੀਂ ਮੈਂ ਮੈਚ ਦੇਖਦੀ ਹਾਂ ਜਿਹੜੇ ਮੈਚ ਲੰਘ ਚੁੱਕੇ ਹੁੰਦੇ ਹਨ ਉਹਨਾਂ ਨੂੰ ਵੀ ਮੈਂ ਟੀ ਵੀ 'ਤੇ ਉੱਤੇ ਦੇਖਦੀ ਹਾਂ ਜਿਸ ਦਿਨ ਮੈਚ ਆਉਣਾ ਹੁੰਦਾ ਹੈ ਉਹ ਮੈਂ ਲਾਈਵ ਟੀ ਵੀ 'ਤੇ ਦੇਖਦੀ ਹਾਂ ਮੈਂ ਮੈਚ ਦੇ ਨਾਲ ਨਾਲ ਫੁੱਲੇ ਵੀ ਖਾਂਦੀ ਹਾਂ ਅਸੀਂ ਸਾਰੇ ਜਣੇ ਰਲ ਕੇ ਮੈਚ ਦੇਖਦੇ ਹਾਂ ਕਦੇ ਕਦੇ ਅਸੀਂ ਮੈਚ ਆਪਣੇ ਦੋਸਤਾਂ ਨਾਲ ਵੀ ਟੀ ਵੀ 'ਤੇ ਦੇਖਦੇ ਹਾਂ ਇਸ ਤਰ੍ਹਾ ਖੇਡਾਂ ਸਾਡੇ ਮਨੋਰੰਜਨ ਦਾ ਸਾਧਨ ਹਨ ਇਸ ਤੋਂ ਇਲਾਵਾ ਮੈਂ ਹੋਰ ਬਹੁਤ ਸਾਰੀਆਂ ਖੇਡਾਂ ਦੇਖਦੀ ਹਾਂ ਜਿਵੇਂ ਫੁੱਟਬਾਲ